ਹੈਲੋ ਹਾਂਜੀ ਕਾਲਾ ਬਟੀਕ ਤੋਂ ਬੋਲਦੇ ਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਹੋਰ ਸੁਣਾਓ ਵਧੀਆ ਠੀਕ ਠਾਕ ਹਾਂਜੀ ਉਹ ਮੈਡਮ ਜੀ ਮੈਨੂੰ ਤੁਹਾਡੀ ਤਫਰੀਫ ਹੋਈ ਸੀ ਵੀ ਇਹ ਸੂਟ ਬਹੁਤ ਵਧੀਆ ਸਿਓ ਲੈਂਦੇ ਆ ਉਹ ਨਾ ਮੈਂ ਤੁਹਾਡੇ ਕੋਲੋਂ ਇੱਕ ਵਿਆਹ ਵਾਲਾ ਸੂਟ ਸਿਲਾਉਣਾ ਸੀ ਅਤੇ ਉਹ ਸਿੰਪਲ ਸਿਲਾਉਣਾ ਜਿਵੇਂ ਪਹਿਲੇ ਰਿਵਾਜ ਦਾ ਪੰਜਾਬੀ ਸੂਟ ਹੁੰਦਾ ਹਾਂਜੀ ਅਤੇ ਉਹ ਕਦੋਂ ਦਿਓਗੇ ਜਲਦੀ ਚਾਹੀਦਾ ਸਾਨੂੰ ਅੱਛਾ ਹਾਂਜੀ ਨਾਪ ਦੇ ਜਾਵਾਂਗੇ ਜੀ ਅਤੇ ਹੋਰ ਕੋਈ ਵੀ ਸਾਨੂੰ ਹਫ਼ਤੇ ਤੱਕ ਚਾਹੀਦਾ ਜੀ ਹਾਂਜੀ ਅੱਛਾ ਜੀ ਉਹ ਮੈਡਮ ਜੀ ਦੇਖ ਲਓ ਜੇ ਤੁਸੀਂ ਆਪ ਲੈ ਆਓਗੇ ਤਾਂ ਵਧੀਆ ਨਹੀਂ ਅੱਛਾ ਜੀ ਠੀਕ ਆ ਜੀ ਫਿਰ ਹਾਂਜੀ ਉਹ ਐਂਉਂ ਹੋ ਜਾਂਦਾ ਨਾ ਕਈ ਵਾਰੀ ਜੇ ਅਸੀਂ ਦੇ ਜਾਈਏ ਤਾਂ ਤੁਹਾਨੂੰ ਨਾ ਕੋਈ ਦਿੱਕਤ ਆਵੇ ਤੁਸੀਂ ਨਾ ਕਹੋ ਵੀ ਇਸ ਤਰ੍ਹਾਂ ਦੀ ਲਿਆਉਣੀ ਸੀ ਤਾਂ ਮੈਂ ਕਿਹਾ ਸੀ ਅੱਛਾ ਹਾਂਜੀ ਹਾਂਜੀ ਹੋਰ ਕੋਈ ਜੇ ਤੁਸੀਂ ਮੇਰਾ ਵਧੀਆ ਸੂਟ ਸਿਓ ਦਿਓਗੇ ਨਾ ਅਤੇ ਤੁਹਾਡੀ ਮੈਨੂੰ ਦੱਸ ਪਈ ਸੀ ਦੋ ਤਿੰਨ ਤੁਸਾਂ ਸੂਟ ਸੀਤੇ ਸੀ ਸਾਡੇ ਪਿੰਡ ਦੇ ਵੀ ਉਹਨਾਂ ਨੇ ਦੱਸ ਪਾਈ ਸੀ ਤੁਹਾਡੀ ਹਾਂਜੀ ਉਹ ਕਹਿੰਦੇ ਹਾਂਜੀ ਨਹੀਂ ਮੈਂ ਦੋ ਤਿੰਨ ਸੂਟ ਤੁਹਾਨੂੰ ਹੋਰ ਵੀ ਦੇਵਾਂਗੀ ਆਪਣੇ ਸਾਡੇ ਆਪਣੇ ਪਰਿਵਾਰ ਦੇ ਹੀ ਆ ਅਤੇ ਉਹ ਬਾਅਦ 'ਚ ਸਿਵਾਉਣੇ ਆ ਉਹ ਕਹਿੰਦੇ ਪਹਿਲਾਂ ਤੂੰ ਸਿਲਾ ਲਾ ਅਤੇ ਸ਼ਰਾਰਾ ਸੂਟ ਸਿਓ ਲੈਂਦੇ ਜੀ ਸਿੰਪਲ ਸੀਊਂਦੇ ਜੀ ਮੈਂ ਕਿਹਾ ਕਈ ਵਾਰੀ ਆਪਣੇ ਗੁੜੀਆ ਨਾ ਉਹਨਾਂ ਨੇ ਸਿਲਾਉਣੇ ਆ ਅਤੇ ਇਸ ਕਰਕੇ ਮੈਂ ਪੁੱਛਿਆ ਮੈਂ ਕਿਹਾ ਚੱਲ ਜੇ ਅਸੀਂ ਸੀਊਂਦੇ ਜੇ ਫਿਰ ਉਹਨਾਂ ਦੇ ਵੀ ਤੁਹਾਡੇ ਕੋਲ ਸਿਲਾ ਲਈਏ ਉਹ ਸ਼ਰਾਰਾ ਸੂਟ ਕਹਿੰਦੇ ਸੀ ਮੈਡਮ ਜੀ ਸ਼ਰਾਰਾ ਸੂਟ

ਹਾਂਜੀ ਹਾਂਜੀ ਪਹਿਲਾਂ ਤੁਸੀਂ ਮੈਨੂੰ ਮੇਰਾ ਸੂਟ ਤਿਆਰ ਕਰ ਦਿਓ ਫਿਰ ਉਸ ਤੋਂ ਬਾਅਦ ਤੁਹਾਨੂੰ ਉਹਨਾਂ ਦੇ ਲਿਆ ਦੇਵਾਂਗੇ ਜੀ ਅਤੇ ਅਤੇ ਕਿੰਨੇ ਪੈਸੇ ਪੈਸੇ ਦੱਸੋ ਤੁਸੀਂ ਸੂਟ ਕੀ ਸਿਲਾਈ ਲੈਂਦੇ ਹਾਂਜੀ ਅੱਛ ਮੈਂ ਆਪਣੇ ਨਾਪ ਦਾ ਵੀ ਸੂਟ ਲੈ ਕੇ ਆਵਾਂ ਵੀ ਨਾਲ ਕਿ ਕਿਵੇਂ

ਮੈਂ ਕਿਹਾ ਕਈ ਵਾਰੀ ਵੈਸੇ ਹੀ ਨਾਪ ਲੈਂਦੇ ਆ ਨਾ ਇੰਚੀ ਟੇਪ ਨਾਲ ਕਿ ਜ਼ਰੂਰੀ ਸੂਟ ਹੀ ਲੈ ਕੇ ਆਉਣਾ ਅੱਛਾ ਠੀਕ ਹੈ ਫਿਰ ਕੱਲ੍ਹ ਕਿੰਨੇ ਵਜੇ ਮਿਲਾਂ ਤੁਹਾਨੂੰ ਮੈਂ ਦਸ ਕੁ ਗਿਆਰਾਂ ਵਜੇ ਠੀਕ ਹੈ ਜੀ ਫਿਰ ਮੈਨੂੰ ਬਿਠਾਉਣਾ ਨਾ ਟਾਈਮ ਨਾ ਜ਼ਿਆਦਾ ਲਾਉਣਾ ਹਾ ਕਿਉਂਕਿ ਮੇਰਾ ਮੈਨੂੰ ਬਹੁਤ ਬਿਜ਼ੀ ਹਾਂ ਮੈਂ ਅਤੇ ਇਸ ਕਰਕੇ ਨਹੀਂ ਸਕਦੇ ਹਾਂ ਹੋਰ ਤੁਸੀਂ ਕਿਵੇਂ ਕਿਹੜੇ ਕਿਹੜੇ ਸੂਟ ਸੀਊਂਦੇ ਜੇ ਕਿਵੇਂ ਲਹਿੰਗੇ ਲਹੁੰਗੇ ਵੀ ਸਿਓ ਦੇ ਲੈਂਦੇ ਜੇ ਅੱਛਾ ਜੀ ਠੀਕ ਹੈ ਅਤੇ ਤੁਹਾਡੇ ਕੋਲ ਸੀਤੇ ਪਏ ਹੋਏ ਨੇ ਜੀ ਉਹਨਾਂ ਬੱਚਿਆਂ ਨੂੰ ਵਿਖਾਉਣੇ ਹੋਏ ਜੇ ਇਹੋ ਜਿਹੇ ਅੱਛਾ ਜੀ ਫੋਟੋ ਵਗੈਰਾ ਤੁਹਾਨੂੰ ਵਿਖਾ ਦਿਓ ਜੇ ਅਤੇ ਚਲੋ ਉਹਨਾਂ ਬੱਚਿਆਂ ਨੂੰ ਫਿਰ ਲੈ ਆਵਾਂਗੀ ਹਾਂਜੀ ਇਸ ਕਰਕੇ ਅਤੇ ਹੁਣ ਹਾਂਜੀ ਕਦੋਂ ਆਈਏ ਫਿਰ ਕੱਲ੍ਹ ਆਈਏ ਅੱਛਾ ਠੀਕ ਹੈ ਜੀ ਹੋਰ ਸੁਣਾ ਹਾਂਜੀ ਹਾਂਜੀ ਦੱਸ ਤਾ ਜੀ ਸਿਲਾਈ ਤੁਸੀਂ ਫਿਰ ਥੋੜ੍ਹੀ ਜਿਹੀ ਦੂਸਰਿਆਂ ਨਾਲ ਜਾਇਜ਼ ਜਾਇਜ਼ ਕਰਿਆ ਜੇ ਨਾ ਫਿਰ ਉਹ ਬੱਚੇ ਜਲਦੀ

ਓਹ ਮੈਂ ਓਹ ਮੈਡਮ ਜੀ ਕਈ ਵਾਰੀ ਇਹ ਹੁੰਦਾ ਜੇ ਥੋੜ੍ਹੀ ਜਿਹੀ ਸਿਲਾਈ ਹੋ ਜੇ ਨਾ ਥੋੜ੍ਹੀ ਜਿਹੀ ਜਾਇਜ਼ ਤਾਂ ਭੱਜ ਕੇ ਕੱਪੜੇ ਆਪਣੇ ਆਪ ਹੀ ਆਉਂਦੇ ਨੇ ਉਹ ਕਹਿੰਦੇ ਸਾਡੇ ਵੀ ਦਿਓ ਹਾਂਜੀ ਹਾਂਜੀ ਹਾਂਜੀ ਹਾਂਜੀ ਬਹੁਤ ਵਧੀਆ ਹੈ ਅਤੇ ਲੈਸ਼ ਵਾਲੀਆਂ ਦੁਕਾਨਾਂ ਤੁਹਾਡੇ ਉਧਰ ਨੇੜੇ ਹੈ ਕੋਈ ਬਜ਼ਾਰ 'ਚ

ਅੱਛਾ ਅਤੇ ਕਿਹੋ ਜਿਹੀ ਲਾਓਗੇ ਫਿਰ ਜ਼ਿਆਦੀ ਚੌੜੇ ਵਾਲੀ ਲਾਓਗੇ ਕਿ ਬਰੀਕ ਵਾਲੀ ਅੱਛਾ ਪਾਈਪਿੰਗਰ ਨਾ ਲਵਾ ਲਈਏ

ਅੱਛਾ ਜੀ ਚਲੋ ਫਿਰ ਇਸ ਤਰ੍ਹਾਂ ਕਰਦੇ ਹਾਂ ਮੈਡਮ ਜੀ ਕੱਲ੍ਹ ਮੈਂ ਆਵਾਂਗੀ ਨਾ ਕੱਲ ਆਪਾਂ ਤੁਸੀਂ ਮੇਰੇ ਨਾਲ ਹੀ ਮੈਂ ਤੁਹਾਡੇ ਚੱਲ ਫਿਰਾਂਗੀ ਤਾਂ ਆਪਾਂ ਪਸੰਦ ਕਰ ਲਵਾਂਗੇ ਓਕੇ ਧੰਨਵਾਦ